ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਆ ਮੈਂ ਇਸ ਨੂੰ ਆਪਣਾ ਕਰੀਅਰ ਵਜੋਂ ਬਣਾਉਣਾ ਚਾਹੁੰਦੀ ਹਾਂ ਮੈਂ ਫੋਟੋਗ੍ਰਾਫੀ ਆਪਣੇ ਪਿਤਾ ਜੀ ਤੋਂ ਸਿੱਖੀ ਸੀ ਕਿਉਂਕਿ ਉਹ ਵੀ ਇੱਕ ਫੋਟੋਗ੍ਰਾਫਰ ਹਨ ਤਾਂ ਮੈਨੂੰ ਵਿਆਹਾਂ 'ਤੇ ਜੋੜੀ ਵੀ ਫੋਟੋਆਂ ਖਿੱਚਣੀਆਂ ਉਹਨਾਂ ਦੇ ਪੋਜ਼ ਬਣਾਉਣੇ ਬਹੁਤ ਚੰਗੇ ਲੱਗਦੇ ਹਨ ਮੈਂ ਕਈ ਵਾਰ ਉਹਨਾਂ ਨਾਲ ਵੀ ਗਈ ਹਾਂ ਉਹਨਾਂ ਦਾ ਕੰਮ ਕਰਵਾਉਣ ਉਹਨਾਂ ਦੀ ਮਦਦ ਕਰਵਾਉਣ ਤਾਂ ਉਹ ਵੀ ਮੇਰੇ ਤੋਂ ਬਹੁਤ ਖੁਸ਼ ਹੁੰਦੇ ਹਨ ਅਤੇ ਮੇਰੇ 'ਤੇ ਬਹੁਤ ਪਰਾਊਡ ਫੀਲ ਕਰਦੇ ਹਨ ਮੈਂ ਜ਼ਿਆਦਾਤਰ ਲਾਈਵ ਤਸਵੀਰਾਂ ਖਿੱਚਦੀ ਹਾਂ ਮੈਨੂੰ ਕੁਦਰਤ ਦੀਆਂ ਤਸਵੀਰਾਂ ਖਿੱਚਣੀਆਂ ਵੀ ਬਹੁਤ ਵਧੀਆ ਲੱਗਦੀਆਂ ਹਨ ਹੁਣ ਤੱਕ ਮੈਂ ਕਈ ਸਾਰੇ ਕੰਪੀਟੀਸ਼ਨ ਵਿੱਚ ਵੀ ਭਾਗ ਲੈ ਚੁੱਕੀ ਹਾਂ ਜਿਨ੍ਹਾਂ ਵਿੱਚ ਮੈਨੂੰ ਪ੍ਰਾਈਜ ਵੀ ਮਿਲੇ ਹਨ ਅਤੇ ਮੈਂ ਆਮ ਤੌਰ 'ਤੇ ਮੈਂ ਲੋ ਲੋਕਾਂ ਦੀਆਂ ਫੋਟ ਤਸਵੀਰਾਂ ਹੀ ਖਿੱਚਦੀ ਹਾਂ ਤਾਂ ਉਹ ਬਹੁਤ ਖੁਸ਼ ਹੁੰਦੇ ਨ ਹਨ ਕਿਉਂਕਿ ਮੇਰੇ ਐਂਗਲ ਤੋਂ ਲਿੱਤੀਆਂ ਹੋਈਆਂ ਤਸਵੀਰਾਂ ਬਹੁਤ ਹੀ ਅਲਗ ਅਤੇ ਉਭਰ ਕੇ ਆਉਂਦੀਆਂ ਹਨ ਜੋ ਕਿ ਇੱਕ ਇਨਸਾਨ ਨੂੰ ਸਭ ਤੋਂ ਖੂਬਸੂਰਤ ਦਿਖਾਉਂਦੀਆਂ ਹਨ ਅਤੇ ਮੈਂ ਇਸੇ ਕਰ ਇਸ ਸ਼ੌਂਕ ਨੂੰ ਆਪਣਾ ਕਰੀਅਰ ਬਣਾਉਂਗੀ ਅਤੇ ਇਹ ਤਸਵੀਰਾਂ ਇਹ ਤਸਵੀਰਾਂ ਨੂੰ ਮੈਂ ਕੋਂਪਟੀਸ਼ਨ ਵਿੱਚ ਵੀ ਭਾਗ ਲੈ ਕੇ ਜਿੱਤ ਹਾਸਲ ਕਰਵਾਉਂਗੀ